ਬਾਵਾ ਪੰਜਾਬੀ ਇੱਕ ਗੀਤ ਹੈ ਜੋ ਬਹੁਤ ਹੀ ਪ੍ਰਸਿੱਧ ਅਤੇ ਮਸ਼ਹੂਰ ਹੈ ਇਸ ਗੀਤ ਨੂੰ ਵੱਖ ਵੱਖ ਗੀਤਕਾਰਾਂ ਨੇ ਗਾਇਆ ਹੈ ਕਿ ਇਹ ਗੀਤ ਤਾਂ ਕਰਕੇ ਬਹੁਤ ਪ੍ਰਸਿੱਧ ਹੈ ਸੋ ਇਸ ਗੀਤ ਦੇ ਕੁਝ ਬੋਲ ਨੇ ਉਹ ਬੋਲ ਮਿੱਟੀ ਦੇ ਬਾਵਿਆ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਉਹ ਮੇਰਾ ਸੋਹਣਾ ਮਾਹੀ ਆ ਜਾ ਹੋ ਉਹ ਮਿੱਟੀ ਦਾ ਮੈਂ ਬਾਵਾ ਬਣਾਇਆ ਉੱਤੇ ਚਾੜ੍ਹ ਦਿੱਤੀ ਆ ਖੇਸੀ ਵਤਨਾ ਵਾਲੇ ਮਾਣ ਕਰਨ ਕੀ ਮੈਂ ਮਾਣ ਕਰਾਂ ਪਰਦੇਸੀ ਸੋ ਇਹ ਗੀਤ ਕਾਫੀ ਗਾਇਕਾਂ ਨੇ ਆਪਣੇ ਹਿਸਾਬ ਦੇ ਨਾਲ ਗਾਇਆ ਹੈ ਸੋ ਇਸ ਕਰਕੇ ਇਹ ਗੀਤ ਬਹੁਤ ਪ੍ਰਸਿੱਧ ਹੈ